ਮੈਂ ਰੋਜ਼ ਸਵੇਰੇ ਅਖ਼ਬਾਰ ਪੜ੍ਹਦਾ ਹਾਂ ਅਤੇ ਹੋਰਾਂ ਨੂੰ ਵੀ ਉਤਸ਼ਾਹਿਤ ਕਰਦਾ ਕਿ ਅਖ਼ਬਾਰ ਪੜ੍ਹਨੀ ਚਾਹੀਦੀ ਮੇਰੇ ਬੱਚੇ ਛੋਟੇ ਨੇ ਲੇਕਿਨ ਫਿਰ ਵੀ ਮੈਂ ਜਦ ਅਖ਼ਬਾਰ ਪੜ੍ਹਦਾਂ ਉਹ ਮੇਰੇ ਕੋਲ ਆ ਕੇ ਬਹਿ ਜਾਂਦੇ ਨੇ ਅਤੇ ਮੈਂ ਉਹਨਾਂ ਨੂੰ ਅਖ਼ਬਾਰ ਪੜ੍ਹ ਕੇ ਸੁਣਾਉਂਦਾ ਹਾਂ ਅਤੇ ਉਹਨਾਂ ਨੂੰ ਵੀ ਦਿੰਦਾ ਹਾਂ ਕਿ ਉਹ ਵੀ ਹੈਡਿੰਗਸ ਪੜ੍ਹ ਕੇ ਮੈਨੂੰ ਦੱਸਣ ਤਾਂ ਜੋ ਉਹਨਾਂ ਨੂੰ ਪੰਜਾਬੀ ਪੜ੍ਹਨੀ ਆਵੇ ਅਤੇ ਉਹਨਾਂ ਦਾ ਸਕਿੱਲ ਵੀ ਡਿਵਲਪ ਹੋਵੇ ਪੜ੍ਹਨ ਦਾ